ਤੁਸੀਂ ਇੰਨਡਰਾਈਵ ਕੰਪਨੀ ਤੋਂ ਬੋਲ ਰਹੇ ਹਾਂ ਮੈਂ ਫਤਿਹਗੜ੍ਹ ਸਾਹਿਬ ਤੋਂ ਬੋਲ ਰਹੀ ਹਾਂ ਮੇਰਾ ਨਾਮ ਰਣਪ੍ਰੀਤ ਕੌਰ ਹੈ ਮੈਂ ਤੁਹਾਡੀ ਐਕਸ਼ਨ 'ਤੇ ਕਿ ਇੱਕ ਕੈਬ ਬੁੱਕ ਕੀਤੀ ਸੀ ਮੈਂ ਫਤਿਹਗੜ੍ਹ ਮੈਂ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਏਅਰਪੋਰਟ ਲਈ ਕੈਬ ਕੀਤੀ ਸੀ ਅਤੇ ਅਤੇ ਇਸ ਲਈ ਉਹ ਕੈਬ ਮੇਰੇ ਕੋਲ ਨਹੀਂ ਪਹੁੰਚੀ ਇਸ ਲਈ ਮੈਂ ਡਰਾਇਵ ਸਾਹਿਬ ਤੁਸੀਂ ਡਰਾਇਵ ਸਾਹਿਬ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕਦੋਂ ਤੱਕ ਪਹੁੰਚੋਂਗੇ ਅਤੇ ਮੈਂ ਤਾਂ ਜੋ ਮੈਂ ਜਲਦੀ ਜਾ ਸਕਾਂ ਕਿਰਪਾ ਕਰਕੇ ਮੈਂ ਬਹੁਤ ਸਮੇਂ ਤੋਂ ਤੁਹਾਡੀ ਵੇਟ ਕਰ ਰਹੀ ਹਾਂ ਰਸਤੇ ਵਿੱਚੋਂ ਹੋਰ ਵੀ ਬਹੁਤ ਸਾਰੀਆਂ ਟਰੈਫਿਕ ਬਹੁਤ ਸਾਰੀਆਂ ਮੁਸ਼ਕਿਲਾਂ ਵੀ ਆ ਸਕਦੀਆਂ ਹਨ ਅਤੇ ਇਹਦੀ ਮੀਲਾਈਟਸ ਦੀ ਪ੍ਰੋਬਲਮ ਕੋਈ ਟੈਕਨੀਕਲ ਪ੍ਰੋਬਲਮ ਵੀ ਹੋ ਸਕਦੀ ਹੈ ਇਸ ਲਈ ਮੈਂ ਰਸਤੇ ਵਿੱਚ ਇੱਕ ਥਾਂ ਰੈਸਟੋ ਇੱਕ ਰੈਸਟੋਰੈਂਟ ਵਿੱਚ ਵੀ ਰੁਕਣਾ ਹੈ ਅਤੇ ਉੱਥੇ ਵੀ ਥੋੜ੍ਹਾ ਸਮਾਂ ਲੱਗ ਜਾਣਾ ਏ ਇਸ ਕਰਕੇ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਪੂਰੇ ਪੂਰੇ ਟੈਮ 'ਤੇ 'ਤੇ ਕਿਹਾ ਸੀ ਅਤੇ ਫਿਰ ਹੁਣ ਜੇ ਤੁਸੀਂ ਲੇਟ ਹੋਊਗੇ ਅਤੇ ਮੈਂ ਹੋਰ ਵੀ ਲੇਟ ਹੋ ਜਾਣਾ ਤਾਂ ਮੇਰੀ ਫਲਾਈਟ ਮਿਸ ਹੋ ਜਾਣੀ ਹੈ ਇਸ ਕਰਕੇ ਪਲੀਜ਼ ਤੁਸੀਂ ਜਲਦੀ ਆਓ ਅਤੇ ਮੈਨੂੰ ਦੱਸੋ ਕਿ ਕਿੰਨੇ ਸਮੇਂ ਤੱਕ ਤੁਸੀਂ ਪਹੁੰਚ ਜਾਓਗੇ ਤਾਂ ਜੋ ਮੈਂ ਆਪਣੇ ਟੈ ਸਮੇਂ ਸਿਰ ਫਲਾਈਟ ਫੜ ਸਕਾਂ